ਹੈਲੋ ਹੈਲੋ ਹਾਂਜੀ ਹਾਂਜੀ ਸਰ ਬੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਸਬਜ਼ੀ ਕਿਸ ਪ੍ਰਕਾਰ ਦੀ ਚਾਹੀਦੀ ਤੁਹਾਨੂੰ ਹਾਂਜੀ ਅੱਛਾ ਜੀ ਸਰ ਸਰ ਮੇਰੇ ਹਿਸਾਬ ਨਾਲ਼ ਤਾਂ ਤੁਸੀਂ ਨਾ ਤਾਂ ਇੱਥੇ ਆਪਣੇ ਰੈਲ ਮਾਜਰੇ ਆ ਇੱਕ ਸ਼ੋਪ ਬਿਕਰਮ ਸ਼ੋਪ ਸਬਜੀਆਂ ਵਾਲੀ ਦੁਕਾਨ ਹੈ ਅਤੇ ਮਤਲਬ ਤੁਸੀਂ ਉੱਥੇ ਚਲੇ ਜਾਓ ਸਰ ਓ ਉੱਥੇ ਹਾਂ ਉੱਥੇ ਜਾ ਕੇ ਤੁਸੀਂ ਸਬਜ਼ੀ ਜਿੱਦਾਂ ਦੀ ਵੀ ਤੁਹਾਨੂੰ ਕੋਆਲਟੀ ਦੀ ਸਬਜ਼ੀ ਚਾਹੀਦੀ ਹੈ 'ਤੇ ਮਤਲਬ ਵਧੀਆ ਕੋਆਲਟੀ ਦੀ ਜਾਂ ਜਿੱਦਾਂ ਦੀ ਵੀ ਚਾਹੀਦੀ ਆ ਤੁਸੀਂ ਉੱਥੇ ਜਾ ਕੇ ਲੈ ਸਕਦੇ ਓ ਸਰ ਹਾਂਜੀ ਬਾਕੀ ਕੋਈ ਵੀ ਦਿੱਕਤ ਹੋਵੇ ਸਰ ਤੁਸੀਂ ਮੈਨੂੰ ਕੋਲ ਕਰ ਦਿਓ ਹਾਂਜੀ ਹਾਂਜੀ ਬਹੁਤ ਵਧੀਆ ਬੈਸਟ ਸਬਜ਼ੀਆਂ ਜੀ ਉੱਥੇ ਜਿੱਦਾਂ ਦੀ ਤੁਸੀਂ ਚਾਹੋਗੇ ਇੱਦਾਂ ਦੀ ਮਿਲ ਸਕਦੀ ਹੈ ਜੀ ਉੱਥੇ ਸਬਜ਼ੀ ਨਹੀਂ ਨਹੀਂ ਸਰ ਸਬਜ਼ੀ ਬਿਲਕੁਲ ਸਾਫ਼ ਰੱਖਦੇ ਹੈ ਤੁਸੀਂ ਬਸ ਬਿਕਰਮ ਸ਼ੋਪ 'ਤੇ ਚਲੇ ਜਾਓ ਸਬਜ਼ੀਆਂ ਵਾਲੀ ਦੁਕਾਨ 'ਤੇ ਅਤੇ ਮਤਲਬ ਬਹੁਤ ਵਧੀਆ ਉਹਨਾਂ ਦੀਆਂ ਸਬਜੀਆਂ ਨੇ ਮਤਲਬ ਜਿੱਦਾਂ ਹਾਈ ਕੋਆਲਟੀ ਚਾਹੀਦੀ ਹਾਈ ਕੋਆਲਟੀ 'ਚ ਵੀ ਸਬਜ਼ੀ ਮਿਲ ਜਾਂਦੀ ਆ ਜੇ ਲੋਅ ਕੋਆਲਟੀ ਚਾਹੀਦੀ ਲੋਅ ਕੋਆਲਟੀ 'ਚ ਵੀ ਸਬਜ਼ੀ ਮਿਲ ਜਾਂਦੀ ਹੈ ਹਾਂਜੀ ਬਿਲਕੁੱਲ ਫ੍ਰੈਸ਼ ਹੈ ਸਰ ਸਬਜ਼ੀ ਬਹੁਤ ਵਧੀਆ ਹੈ ਸਰ ਉਨ੍ਹਾਂ ਦੀ ਬਾਕੀ ਤੁਸੀਂ ਜਾ ਕੇ ਪਤਾ ਕਰ ਲਿਓ ਜੀ ਥੈਂਕ ਯੂ ਸਰ ਥੈਂਕ ਯੂ